ਸਤਿ ਸ਼੍ਰੀ ਅਕਾਲ ਜੀ ਬਸ ਵਧੀਆ ਤੁਸੀਂ ਸੁਣਾਉ ਪ੍ਰੋਫੈਸਰ ਹਰਮਨਦੀਪ ਕੌਰ ਬਸ ਵਧੀਆ ਚਲੀ ਜਾਂਦੀ ਹੈ ਤੁਹਾਨੂੰ ਤਾਂ ਪਤਾ ਹੀ ਆ ਅੱਜ ਕੱਲ੍ਹ ਦੇ ਬੱਚਿਆਂ ਦਾ ਤੁਸੀਂ ਸੁਣਾਉ ਤੁਹਾਡੇ ਇੱਧਰ ਕਿਵੇਂ ਹਾਲ ਚਾਲ ਹਾਂਜੀ ਹਾਂਜੀ ਅੱਜ ਕੱਲ੍ਹ ਇਹ ਜ਼ਿਆਦਾ ਚੱਲ ਰਿਹਾ ਨੋਨ ਮੈਡੀਕਲ ਜਾਂ ਮੈਡੀਕਲ ਅਤੇ ਜਿਹੜੇ ਮੈਡੀਕਲ ਵਾਲੇ ਆ ਉਹ ਅੱਜ ਕੱਲ੍ਹ ਜ਼ਿਆਦਾਤਰ ਫਿਜੀਓਥੈਰਪੀ ਵੱਲ ਜਾਈ ਜਾਂਦੇ ਆ ਬਿਲਕੁਲ ਸਹੀ ਗੱਲ ਆ ਬਹੁਤ ਫਾਇਦਾ ਬਹੁਤ ਫਾਇਦਾ ਦੋਨੇ ਸਟ੍ਰੀਮਾਂ 'ਚ ਹਾਂਜੀ ਹਾਂਜੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੀ ਜਾਂਦਾ ਵੀ ਕੀ ਕੀ ਫਾਇਦੇ ਹੈ ਜਿਵੇਂ ਜੋਬਾਂ ਜੋਬਸ ਸਿਕਿਓਰ ਹੈ ਠੀਕ ਹੈ ਨਾਲੇ ਵਧੀਆ ਲੋਕਾਂ ਦੀ ਸੇਵਾ ਵੀ ਹੋਈ ਜਾਂਦੀ ਆ ਨਾਲੇ ਬੱਚੇ ਸਿੱਖਦੇ ਹੈ ਤਾਂ ਵਧੀਆ ਹੈ ਵਧੀਆ ਇਨਕਮ ਦਾ ਸੋਰਸ ਆ ਜੀ ਜੀ ਬਿਲਕੁਲ

ਹਾਂਜੀ ਹਾਂਜੀ ਬਹੁਤ ਫਾਇਦੇਮੰਦ ਹੈ ਐਦਾਂ ਦੇ ਇਨੋਵੇਟਿਵ ਆਈਡੀਆਸ ਅਤੇ ਐਦਾਂ ਦੇ ਇਨੋਵੇਟਿਵ ਪ੍ਰੋਜੈਕਟਸ ਦੀ ਬਹੁਤ ਲੋੜ ਆ ਦੋਨੇ ਕੰਪਿਊਟਰ ਸਾਇੰਸ ਐਂਡ ਹੈਲਥ ਕੰਬਾਈਨ ਹੋ ਕੇ ਇਕੱਠੇ ਹੋ ਕੇ ਬਹੁਤ ਅੱਗੇ ਤੱਕ ਬਹੁਤ ਫਾਇਦਾ ਪਹੁੰਚਾ ਸਕਦੇ ਹਾਂਜੀ ਤੁਸੀਂ ਇਹ ਦੇਖੋ ਕਿੱਥੇ ਬਾਕੀ ਜੇ ਆਪਾਂ ਸਟ੍ਰੀਮਾਂ ਦੇਖੀਏ ਜਾਂ ਅੱਜ ਕੱਲ੍ਹ ਹੈ ਨਾ ਜਿਹਨੂੰ ਦੇਖੋ ਦਵਾਈਆਂ 'ਤੇ ਹੀ ਹੈ ਨਹੀਂ ਬਿਨਾ ਦਵਾਈ ਤੋਂ ਇਕੱਲੇ ਆਪਣੀ ਫਿਜੀਓਥੈਰਪੀ ਆ ਫਿਜੀਓਥੈਰਪੀ 'ਚ ਨਾ ਕੋਈ ਦਵਾਈ ਦੇਣੀ ਬਸ ਤੁਹਾਡੇ 'ਚ ਸਕਿੱਲ ਹੋਣਾ ਚਾਹੀਦਾ ਅਤੇ ਆਪਦੀ ਬਿਮਾਰੀ ਦੱਸੋ ਅਗਲਾ ਤੁਹਾਨੂੰ ਬਸ ਪੰਜ ਸੱਤ ਸੀਟਿੰਗਾਂ 'ਚ ਸਹੀ ਕਰ ਦਿੰਦਾ ਨਾ ਤੁਹਾਨੂੰ ਦਵਾਈ ਖਾਣੀ ਪੈਂਦੀ ਹੈ ਨਾ ਫਿਰ ਦਵਾਈ ਦੇ ਪੁੱਠੇ ਸਿੱਧੇ ਸਾਈਡ ਇਫੈਕਟ ਆਉਂਦੇ ਆ ਆਪਾਂ ਨੂੰ ਨਾਲੇ ਦਰਦ ਦਾ ਦਰਦ ਗਾਇਬ ਹਾਂਜੀ ਹਾਂਜੀ ਜ਼ਰੂਰ ਸਤਿ ਸ਼੍ਰੀ ਅਕਾਲ ਜੀ